ਇੱਕ ਸਮੇਂ ਸੀ ਜਦ ਸਕੂਲ ਅਤੇ ਕਾਲਜ ਦੀ ਪੜ੍ਹਾਈ ਪ੍ਰਤੀ ਬੱਚੇ ਸਮਰਪਿਤ ਹੁੰਦੇ ਸਨ ਪਰ ਅਜੋਕੇ ਸਮੇਂ ਦੀ ਪੀੜ੍ਹੀ ਆਨਲਾਈਨ ਕਲਾਸਾਂ ਦੇ ਜੰਜਾਲ 'ਚ ਫਸ ਚੁੱਕੀ ਹੈ ਆਨਲਾਈਨ ਕਲਾਸਾਂ ਦਾ ਸਿਹਰਾ ਦੋ ਹਜ਼ਾਰ ਵੀਹ 'ਚ ਆਏ ਕਰੋਨਾ ਨੂੰ ਜਾਂਦਾ ਹੈ ਜਿਹਦੇ ਕਰਕੇ ਸਾਰੀ ਦੁਨੀਆ 'ਚ ਬਿਮਾਰੀ ਕਰਕੇ ਗਰੈਂਹ 'ਚ ਬੈਠ ਕੇ ਆਨਲਾਈਨ ਕੰਮ ਸ਼ੁਰੂ ਹੋ ਗਏ ਚਾਹੇ ਉਹ ਪੜ੍ਹਾਈ ਹੋਵੇ ਜਾਂ ਨੌਕਰੀ ਪੇਸ਼ੇ ਬੰਦੇ ਦਾ ਕੰਮ ਆਨਲਾਈਨ ਕਲਾਸਾਂ ਨਾਲ ਇੱਕ ਤਾਂ ਬੱਚੇ ਆਲਸੀ ਹੋ ਗਏ ਹਨ ਕਿਉਂਕਿ ਆਨਲਾਈਨ ਸਕੂਲਿੰਗ ਨਾਲ ਬੱਚਿਆਂ ਦੀ ਸਰੀਰਕ ਮਿਹਨਤ ਬਹੁਤ ਘੱਟ ਗਈ ਹੈ ਦੂਜਾ ਆਨਲਾਈਨ ਸਕੂਲਿੰਗ ਨਾਲ ਬੱਚਿਆਂ ਦੀ ਅੱਖਾਂ 'ਤੇ ਵੀ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਰਾ ਦਿਨ ਸਕਰੀਨ ਉੱਤੇ ਦੇਖ ਦੇਖ ਕੇ ਪੜ੍ਹਾਈ ਕਰਨ ਨਾਲ ਅੱਖਾਂ 'ਤੇ ਵੀ ਪ੍ਰਭਾਵ ਪੈਂਦਾ ਹੈ ਪਰ ਅਖੀਰ ਸੱਚਾਈ ਇਹੀ ਹੈ ਕਿ ਸਾਨੂੰ ਦੁਨੀਆ ਦੇ ਨਾਲ ਨਾਲ ਚੱਲਣਾ ਪੈਂਦਾ ਹੈ ਧੰਨਵਾਦ